ਮੇਰਾ ਮਨਪਸੰਦ ਕਵੀ ਹੈਰੀ ਬਰਾੜ ਹੈ ਜੋ ਕਿ ਬਹੁਤ ਹੀ ਵਧੀਆ ਕਵਿਤਾਵਾਂ ਲਿਖਦਾ ਹੈ ਇਹਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਇਹਨੇ ਇਤਿਹਾਸਿਕ ਕਿਤਾਬਾਂ ਵੀ ਲਿਖੀਆਂ ਹਨ ਦੁਨੀਆਦਾਰੀ ਬਾਰੇ ਇਸ਼ਕ ਰੂਹਾਨੀ ਬਾਰੇ ਮਤਲਬ ਹੋਰ ਵੀ ਕਈ ਤਰ੍ਹਾਂ ਦੀਆਂ ਇਹਨੇ ਬਹੁਤ ਹੀ ਜ਼ਿਆਦਾ ਕਿਤਾਬਾਂ ਲਿਖੀਆਂ ਹਨ ਮੈਂ ਇਹਦੀਆਂ ਕਿਤਾਬਾਂ ਪੜ੍ਹ ਪੜ੍ਹੀਆਂ ਵੀ ਹਨ ਮੇਰੀ ਆਦਤ ਆ ਮੈਂ ਹਰ ਰੋਜ਼ ਇਹਦੀ ਦੋ ਜਾਂ ਤਿੰਨ ਪੰਨੇ ਹਰੇਕ ਹਰ ਇੱਕ ਕਿਤਾਬ ਦੇ ਪੜ੍ਹਨੇ ਹੀ ਪੜ੍ਹਨੇ ਹਨ ਇਹਦੀ ਕਿਤਾਬ ਬਹੁਤ ਹੀ ਜ਼ਿਆਦਾ ਹੈ ਬਹੁਤ ਹੀ ਜ਼ਿਆਦਾ ਵਧੀਆ ਕਿਤਾਬ ਲਿਖ ਰਿਹਾ ਇਹਦੀ ਸੋਚ ਬਹੁਤ ਵਧੀਆ ਹੈ ਇਹ ਕਵਿਤਾਵਾਂ ਲਿਖਣ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੰਮ ਕਰਦਾ ਹੈ ਆਪਣੇ ਘਰ ਦੇ ਕੰਮ ਆਪਣਾ ਘਰ ਦੇ ਕੰਮ ਕਰਦਾ ਖੇਤੀਬਾੜੀ ਕਰਦਾ ਹੋਰ ਵੀ ਇਹ ਇਸ ਤੋਂ ਇਲਾਵਾ ਇਹ ਆਪਣੇ ਕੰਮ ਵਿੱਚ ਰੁੱਝਿਆ ਰਹਿੰਦਾ ਹੈ ਇਹਦੇ ਕੋਲ ਗੱਡੀਆਂ ਹਨ ਥਾਰ ਆਟੋ ਅਤੇ ਰੇਂਜ ਰੋਵਰ ਅਤੇ ਇਸ ਇਹਦੇ ਕੋਲ ਟਰੈਕਟਰ ਵੀ ਹਨ ਮਤ ਮਤਲਬ ਇਹ ਜ਼ਿਆਦਾ ਜ਼ਿਆਦਾ ਆਪਣਾ ਸਮਾਂ ਇਹ ਕਵਿਤਾਵਾਂ ਲਿਖਣ ਵਿੱਚ ਹੀ ਬਤੀਤ ਕਰਦਾ ਹੈ